ਸਰੀਰਕ ਕਸਰਤ ਅਤੇ ਯੋਗੇ ਵਿੱਚ ਬਹੁਤ ਅੰਤਰ ਨੇ ਸਰੀਰਕ ਕਸਰਤ ਦੀ ਜੇ ਗੱਲ ਕੀਤੀ ਜਾਵੇ ਇਸ ਨਾਲ ਸਰੀਰ ਦੇ ਵਿੱਚ ਜਾਨ ਤਾਂ ਆ ਜਾਂਦੀ ਹੈ ਜਿੱਦਾਂ ਕਿ ਇਹ ਸਰੀਰਕ ਕਸਰਤ ਆਪਣੇ ਬਾਡੀ ਦੇ ਜਿਹੜੇ ਮਸਲ ਹੁੰਦੇ ਨੇ ਉਹਨਾਂ ਨੂੰ ਬੂਸ਼ਟ ਕਰਦੀ ਆ ਜਿੱਦਾਂ ਕਿ ਆਪਾਂ ਸਰੀਰਕ ਕਸਰਤ ਲਈ ਜਿੰਮ ਜੁਆਇਨ ਕਰਦੇ ਹਾਂ ਜਿੰਮ ਲਗਾਉਦੇ ਹਾਂ ਉਸ ਦੇ ਨਾਲ ਸਰੀਰ ਦੇ ਬਾਹਰੋਂ ਜਿਹੜੀ ਸਰੀਰ ਦੀ ਅ ਬਨਾਵਟ ਹੁੰਦੀ ਆ ਉਹ ਸਹੀ ਤਰ੍ਹਾਂ ਨਾਲ ਬਣ ਜਾਂਦੀ ਆ ਪਰ ਸਰੀਰ ਦੇ ਅੰਦਰ ਜਾਨ ਨਹੀਂ ਰਹਿੰਦੀ ਹੈਗੀ ਕਿਉਂਕਿ ਜਿੰਮ ਦੇ ਨਾਲ ਆਪਾਂ ਨੂੰ ਪ੍ਰੋਟੀਨ ਵਗੈਰਾ ਦੀ ਲੋੜ ਪੈਂਦੀ ਆ ਉਹ ਖਾਂਦੇ ਆ ਤਾਂ ਸਰੀਰ ਦੇ ਮਸਲ ਬਣਦੇ ਨੇ ਅਤੇ ਜੇ ਯੋਗੇ ਦੀ ਗੱਲ ਕੀਤੀ ਜਾਵੇ ਯੋਗੇ ਦੇ ਯੋਗਾ ਕਰਨ ਦੇ ਨਾਲ ਸਾਰੇ ਸਰੀਰ ਦੇ ਅੰਦਰ ਜਾਨ ਪੈਂਦੀ ਆ ਸਾਰਾ ਸਰੀਰ ਮਜ਼ਬੂਤ ਹੋ ਜਾਂਦਾ ਏ ਅਤੇ ਇਸ ਦੇ ਨਾਲ ਯੋਗੇ ਦੇ ਨਾਲ ਤੁਸੀਂ ਪ੍ਰੋਟੀਨ ਦੀ ਲੋੜ ਨਹੀਂ ਪੈਂਦੀ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਨਾਲੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਬੰਦਾ ਤੰਦਰੁਸਤ ਰਹਿੰਦਾ ਯੋਗਾ ਕਰਨ ਨਾਲ ਬਸ ਦੋਨਾਂ 'ਚ ਇਹੀ ਅੰਤਰ ਆ ਜੀ